ਹੈਲੋ ਸਤਿ ਸ਼੍ਰੀ ਅਕਾਲ ਕਿਵੇਂ ਹੋ ਤੁਸੀਂ ਹੈਲੋ ਮੈਂ ਕਿਹਾ ਕਿਵੇਂ ਹੋ ਤੁਸੀਂ ਮੈਂ ਵੀ ਠੀਕ ਹਾਂ ਹੋਰ ਤੁਸੀਂ ਆਪਣਾ ਘਰ ਬਣਾ ਬਣਾਉਣ ਬਾਰੇ ਸੋਚ ਰਹੇ ਤੁਸੀਂ ਆਪਣਾ ਕੰਮ ਸਟਾਰਟ ਕੀਤੇ ਤੇ ਘਰ ਦਾ ਅੱਛਾ ਅਤੇ ਹੁਣ ਤੁਹਾਨੂੰ ਕਿੰਨਾ ਕੁ ਟਾਈਮ ਮਤਲਬ ਇੱਦਾਂ ਲੱਗ ਜਾਏਗਾ ਘਰ ਬਣਾਉਣ 'ਚ ਅੱਛਾ ਤਾਂ ਤੁਸੀਂ ਹੁਣ ਮਤਲਬ ਕਿੱਥੇ ਆਪਣੇ ਰਹਿਣ ਦਾ ਸਾਰਾ ਕੀਤਾ ਪ੍ਰਬੰਧ ਅੱਛਾ ਉਹ ਤਾਂ ਵਧੀਆ ਗੱਲ ਹੈ ਕਿ ਤੁਸੀਂ ਉੱਥੇ ਮਤਲਬ ਲਾਗੇ ਤੁਹਾਨੂੰ ਮਿਲ ਗਿਆ ਪਰ ਤੁਹਾਨੂੰ ਇੱਦਾਂ ਤਾਂ ਸਾਰਾ ਸਮਾਨ ਵੀ ਇੱਧਰ ਸ਼ਿਫਟ ਕਰਨਾ ਪਏਗਾ ਤਾਂ ਮਤਲਬ ਤਾਂ ਬਹੁਤ ਮਤਲਬ ਤੁਹਾਨੂੰ ਮੁਸ਼ਕਿਲ ਹੋਣੀ ਹੈ ਕਿਉਂਕਿ ਸਮਾਨ ਤੁਹਾਨੂੰ ਸਾਰਾ ਉੱਧਰ ਰੱਖਣਾ ਪਏਗਾ ਘਰ ਹੁਣ ਤੁਸੀਂ ਮਤਲਬ ਕਿੱਦਾਂ ਦਾ ਮਤਲਬ ਕਿੱਦਾਂ ਦਾ ਡਿਜ਼ਾਇਨ ਕਰਨਾ ਤੁਸੀਂ ਮਤਲਵ ਕੀ ਕੀ ਦੱਸਿਆ ਆਪਣੇ ਘਰ 'ਚ ਮਤਲਬ ਜਿੱਦਾਂ ਸਾਰੀ ਤਿਆਰੀ ਕੀ ਕੀ ਮਤਲਬ ਕਿੰਝ ਕਰਵਾਉਣਾ ਆਪਣੇ ਘਰ 'ਚ ਬਾਹਰ ਮਤਲਬ ਤੁਸੀਂ ਮਤਲਬ ਘਰ ਵੱਡਿਆਂ ਦੇ ਕਹਿਣ 'ਤੇ ਕਰਵਾਉਣਾ ਜੋ ਮਤਲਬ ਉਹ ਕਹਿਣਗੇ ਨਾਲ ਤੁਸੀਂ ਸਾਰੀ ਤਿਆਰੀ ਕਰਵਾ ਕੇ ਮਤਲਬ ਆਓਗੇ ਜਾਂ ਫਿਰ ਮਤਲਬ ਥੋੜ੍ਹਾ ਟਾਈਮ ਲੱਗੇਗਾ ਤੁਹਾਨੂੰ ਦੋ ਮਹੀਨੇ ਤੋਂ ਜ਼ਿਆਦਾ ਹੀ ਲੱਗ ਜਾਏਗਾ ਹਾਂਜੀ ਤੁਸੀਂ ਮਤਲਬ ਸਾਰਾ ਘਰ ਦੀ ਤਿਆਰੀ ਕਰਵਾਉਣੇ ਫਿਰ ਤਾਂ ਤੁਹਾਨੂੰ ਕਾਫੀ ਟਾਈਮ ਲੱਗਣਾ ਹਾਂਜੀ ਅਤੇ ਦੋ ਤਿੰਨ ਮਹੀਨੇ ਬਾਅਦ ਕਿਉਂਕਿ ਤੁਹਾਨੂੰ ਕਾਫੀ ਕੁਛ ਕਰਨਾ ਪੈਣਾ ਸਮਾਨ ਇੱਧਰ ਉੱਧਰ ਕਰਨਾ ਪੈਣਾ ਚਲੋ ਠੀਕ ਹੈ ਫਿਰ